ਨਮਸਕਾਰ ਅਸੀਂ ਇਹ ਪੁੱਛਣਾ ਅਸੀਂ ਇਹ ਪੁੱਛਣਾ ਸੀ ਤੁਹਾਡੇ ਕੋਲ ਸਬਜ਼ੀਆਂ ਕਿਹੜੀਆਂ ਨੇ ਔਰਗੈਨਿਕ ਜਾਂ ਅਨਔਰਗੈਨਿਕ ਕਿਹੜੀਆਂ ਕਿਹੜੀਆਂ ਦੱਸ ਔਰਗੈਨਿਕ ਹੈ ਸਾਨੂੰ ਔਰਗੈਨਿਕ ਹੀ ਚਾਹੀਦੀਆਂ ਸੀ ਅਤੇ ਔਰਗੈਨਿਕ ਦੇ ਵਿੱਚ ਕਿਹੜੀਆਂ ਕਿਹੜੀਆਂ ਨੇ

ਅਤੇ ਇਹਨਾਂ ਇਹਨਾਂ ਇਹਨਾਂ ਦਾ ਇਹਨਾਂ ਦਾ ਰੇਟ ਕੀ ਕੀ ਹੈ

ਤੁਸੀਂ ਕੇ ਜੀ ਦੇ ਹਿਸਾਬ ਨਾਲ ਦੱਸ ਦਿਓ ਸਾਰਿਆਂ ਦੇ ਇੱਕ ਵਾਰੀ ਡਿਟੇਲ 'ਚ ਪਰ ਕੇ ਪਰ ਕੇ ਜੀ

ਠੀਕ ਹੈ ਠੀਕ ਹੈ

ਅੱਛਾ ਠੀਕ ਹੈ ਫਿਰ ਅੱਛਾ ਠੀਕ ਹੈ ਠੀਕ ਹੈ ਅਤੇ ਤੁਸੀਂ ਫਿਰ ਐਂ ਕਰੋ ਫਿਰ ਤੁਸੀਂ ਨਾ ਆਹ ਪੰਜ ਕਿਲੋ ਆਲੂ ਕਰ ਦਿਓ ਅਤੇ ਅਤੇ ਦੋ ਗੁੱਟੀ ਪਾਲਕ ਅਤੇ ਅਤੇ ਇੱਕ ਇੱਕ ਕਿੱਲੋ ਗਾਜਰ ਕਰ ਦਿਓ

ਉਹ ਜਿੰਨਾ ਜਲਦੀ ਹੋ ਸਕੇ ਤੁਸੀਂ ਕਰ ਦਿਓ ਵੀ ਕਦੋਂ ਤੱਕ ਆ ਜੂਗੀ ਉਹ ਤੁਸੀਂ ਦੱਸੋ ਨਾ ਵੀ ਕਿੰਨੇ ਟਾਈਮ ਤੱਕ ਆ ਜਾਏਗੀ ਸਾਡੇ ਕੋਲ

ਅੱਛਾ ਠੀਕ ਹੈ ਜੀ ਹੈਲੋ ਹਾਂਜੀ ਪੇਮੈਂਟ ਫਿਰ ਕੈਸ਼ ਓਨ ਡਿਲੀਵਰੀ ਕਰ ਦੇਈਏ ਕਿਹੜੇ ਕਿਹੜੇ ਮੋਡ ਹੈਗੇ ਨੇ ਤੁਹਾਡੇ ਕੋਲ ਅੱਛਾ ਅੱਛਾ ਠੀਕ ਆ ਓਨਲਾਈਨ ਹੀ ਕਰਨੀ ਹੈ ਕੈਸ਼ ਓਨ ਡਿਲੀਵਰੀ ਨਹੀਂ ਹੁੰਦੀ ਅੱਛਾ ਠੀਕ ਠੀਕ ਹੈ ਸਰ ਠੀਕ ਹੈ ਥੈਂਕ ਯੂ ਥੈਂਕ